ਹੈਲੋ ਹਾਂਜੀ ਸੰਧੂ ਜਵਾਲਰਸ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਨੂੰ ਫੋਨ ਕਰਿਆ ਸੀ ਨਾ ਕੁਛ ਦਿਨਾਂ ਬਾਅਦ ਮੇਰੀ ਮੈਰਿਜ ਐ ਤੇ ਮੈਂ ਜੀ ਮੈਂ ਕੁਛ ਜਿਵੇਂ ਗੋਲਡ ਦੀ ਜਿਵੇਂ ਬਰਾਈਡਲ ਟਾਈਪ ਕਹਿਲੋ ਆਪਦੇ ਵਿਆਹ ਵਾਸਤੇ ਮੈਂ ਜੁਅਲਰੀ ਬਣਾਉਣੀ ਸੀ ਤੇ ਉਸੇ ਨੂੰ ਲੈ ਕੇ ਮੈਂ ਤੁਹਾਨੂੰ ਕੋਲ ਕਰੀ ਸੀ ਵੀ ਤੁਹਾਡਾ ਕਾਫੀ ਨਾਮ ਹੈਗਾ ਸ਼ਹਿਰ ਚ ਹਾਂਜੀ ਤੇ ਮੈਂ ਨਾ ਜਿੰਨੇ ਇੱਕ ਤਾਂ ਜਿਵੇਂ ਮੈਂ ਤੁਸੀਂ ਕਹਿ ਲਓ ਵੀ ਇੱਕ ਹੈਵੀ ਸੈੱਟ ਤਿਆਰ ਕਰਨਾ ਵੀ ਜਿਸ ਤਰ੍ਹਾਂ ਅੱਜ ਕੱਲ ਇੱਕ ਰਾਣੀ ਹਾਰ ਚੱਲ ਰਿਹਾ ਤੇ ਉਹਦੇ ਨਾਲ ਜਿਵੇਂ ਏਅਰਿੰਗ ਵੀ ਵਧੀਆ ਹੁੰਦੇ ਐ ਨਾਲ ਟੀ ਟੀਕਾ ਵਗੈਰਾ ਵੀ ਹੁੰਦਾ ਅੱਛਿਆ ਜੀ ਦੋ ਚੱਲਦੇ ਨਹੀਂ ਮੈਂ ਇੱਕ ਈ ਬਨਵਾਉਨਾ ਨਹੀਂ ਨਹੀਂ ਜੀ ਮੈਂ ਇੱਕ ਲੋਂਗ ਈ ਬਨ ਹਾਂਜੀ ਹਾਂਜੀ ਲੋਂਗ ਈ ਬਨਵਾਉਨਾ ਤੇ ਹੋਰ ਮਤਲਬ ਤੁਸੀਂ ਇਹਦੇ ਵਿੱਚ ਕੀ ਕੀ ਵੀ ਸਾਨੂੰ ਦਿਓਗੇ ਵੀ ਜਿਵੇਂ ਨੈਕਲੇਸ ਤਾਂ ਇੱਕ ਹੀ ਹੋਏ ਠੀਕ ਐ ਜੀ ਠੀਕ ਐ ਜੀ ਠੀਕ ਐ ਕੋਈ ਨਾਲ ਰਿੰਗ ਵਗੈਰਾ ਦੀ ਵੀ ਓਪਸ਼ਨ ਦਓਗੇ ਕੇ ਅੱਛਿਆ ਜੀ ਅੱਛਿਆ ਜੀ ਚਲੋ ਇਹ ਮਤਲਬ ਚਾਰ ਚੀਜ਼ਾਂ ਇਹ ਤਿਆਰ ਹੋ ਜਾਣਗੀਆਂ ਤੇ ਇਹ ਇਹ ਕਿੰਨੇ ਕ ਤੋਲੇ ਚ ਅੰਦਾਜ਼ਾ ਜਾ ਵੀ ਬਣਜੇਗਾ ਵੀ ਚਲੋ ਨਾ ਤਾਂ ਬਹੁਤ ਜਿਆਦਾ ਭਾਰਾ ਬਨੇ ਤੇ ਨਾ ਈ ਬਾਲਾ ਹਲਕਾ ਹੋਵੇ ਠੀਕ ਠੀਕ ਬਨਜੇ ਚਾਰੋਂ ਚੀਜਾਂ ਅੱਛਿਆ ਜੀ ਠੀਕ ਐ ਜੀ ਠੀਕ ਐ ਠੀਕ ਐ ਚਲੋ ਆਪਾਂ ਮਤਲਬ ਪੰਜ ਕ ਤੋਲਿਆ ਚ ਮੰਨ ਕੇ ਚੱਲੀਏ ਵੀ ਤਿਆਰ ਹੋਜੇਗਾ ਠੀਕ ਐ ਜੀ ਠੀਕ ਐ ਜੀ ਤੇ ਇਹ ਇਹ ਚਲੋ ਇੱਕ ਮੈਂ ਥੋੜਾ ਅਲੱਗ ਤੋਂ ਇੱਕ ਦੋ ਰਿੰਗਸ ਵਗੈਰਾ ਵੀ ਲੈਣੀਆਂ ਸੀਗੀਆਂ ਵੀ ਉਹ ਵੀ ਤੁਹਾਨੂੰ ਓਰਡਰ ਦੇਣਾ ਪੈਂਦਾ ਜਾਂ ਕੁਛ ਵੀ ਬਨੇ ਬਨਾਏ ਵੀ ਤੁਹਾਡੇ ਕੋਲ ਡਿਜ਼ਾਇਨ ਹੁੰਦੇ ਆ ਅੱਛਿਆ ਜੀ ਹਾਂਜੀ ਹਾਂਜੀ ਹਾਂਜੀ ਅੱਛਿਆ ਤੇ ਤੇ ਉਹ ਤੁਹਾਡੇ ਕੋਲ ਉਹ ਵੀ ਹੁੰਦਾ ਜਿਵੇਂ ਐਡਜਸਟੇਬਲ ਹੁੰਦੇ ਐ ਸਾਈਜ਼ ਵੀ ਆਪਾਂ ਉਹਨੂੰ ਲੂਜ਼ ਕਰਕੇ ਰਿੰਗ ਨੂੰ ਪਾ ਸਕਦੇ ਆਂ ਵੀ ਕਈ ਵਾਰ ਆਪਾਂ ਨੂੰ ਥੋੜੀ ਸਾਈਜ਼ ਦਾ ਹੁੰਦਾ ਪ੍ਰੋਬਲਮ ਉਹ ਨਾ ਨੀਚੇ ਵਾਲਾ ਜਿਹੜਾ ਹਿੱਸਾ ਉਹ ਥੋੜਾ ਜਿਵੇਂ ਲੂਜ਼ ਹੋ ਜਾਂਦਾ ਵੀ ਰਿੰਗ ਐਡਜਸਟ ਹੋ ਜਾਂਦੀ ਐ ਵੀ ਉਹਨੂੰ ਆਪਾਂ ਥੋੜਾ ਥੱਲੋ ਲੂਜ਼ ਅੱਛਿਆ ਜੀ ਅੱਛਿਆ ਮਤਲਬ ਹੈਗਾ ਤੁਹਾਡੇ ਕੋਲ ਉਹ ਵਾਲਾ ਵੀ ਇੱਥੇ ਵੀ ਰਿੰਗਸ ਦਾ ਅੱਛਿਆ ਜੀ ਠੀਕ ਐ ਠੀਕ ਐ ਚਲੋ ਕੋਈ ਨੀ ਉਹ ਚਲੋ ਤੁਹਾਨੂੰ ਮੈਂ ਥੋੜਾ ਜਿਹਾ ਵੀ ਚਲੋ ਇੱਕ ਤਾਂ ਮੈਂ ਥੋੜਾ ਸੈੱਟ ਦਾ ਕਹਿਨਾ ਸੀ ਚਲੋ ਰਿੰਗਸ ਤਾਂ ਫੇਰ ਤੁਹਾਡੇ ਕੋਲ ਬਨੀਆਂ ਬਨਾਈਆਂ ਵੀ ਹੈਗੀਆਂ ਤੇ ਠੀਕ ਐ ਜੀ ਹਾਂ ਵੀ ਚਲੋ ਮੰਨ ਲਓ ਮੈਨੂੰ ਕੋਈ ਆਪ ਨੂੰ ਮੰਨ ਲਓ ਪਸੰਦ ਐ ਮੈਂ ਕਿਤੇ ਦੇਖਿਆ ਹੋਵੇ ਤਾਂ ਵੀ ਉਹ ਵੀ ਤੁਸੀਂ ਬਣਾ ਦਿਓਗੇ ਠੀਕ ਐ ਜੀ ਠੀਕ ਹਾਂਜੀ

ਹਾਂਜੀ ਹਾਂਜੀ ਠੀਕ ਐ ਠੀਕ ਐ ਠੀਕ ਐ ਜੀ ਚਲੋ ਕੋਈ ਨਹੀਂ ਜੀ ਇੱਕ ਦੋ ਦਿਨਾਂ ਤੱਕ ਆਉਨੇ ਆ ਤੁਹਾਡੀ ਸ਼ੋਪ ਤੇ ਇੱਕ ਤਾਂ ਵੀ ਚਲੋ ਸੈੱਟ ਦਾ ਦੇਖ ਲਾਂਗੇ ਤੇ ਰਿੰਗਸ ਚੋਲ ਤੁਹਾਡੇ ਕੋਲ ਦੇਖ ਲਾਂਗੇ ਜੇ ਬਨੀਆਂ ਬਨਾਈਆਂ ਪਸੰਦ ਆ ਗਈਆਂ ਤਾਂ ਤੇ ਨਹੀਂ ਤਾਂ ਫੇਰ ਨਹੀਂ ਤਾਂ ਫੇਰ ਤੁਹਾਨੂੰ ਦੱਸ ਦਿਆਂਗੇ ਤੇ ਪੰਜੇਬਾਂ ਵੈਗਰਾ ਵੀ ਮਿਲ ਜਾਂਦੀਆਂ ਹਾਂ ਚਲੋ ਉਹ ਵੀ ਚਲੋ ਤੁਹਾਡੀ ਸ਼ੋਪ ਤੇ ਆ ਕੇ ਫਿਰ ਡਿਜ਼ਾਇਨ ਵੈਗਰਾ ਪਸੰਦ ਕਰ ਲਾਂਗੇ ਜੀ ਤੇ ਚਲੋ ਠੀਕ ਐ ਜੀ ਫੇਰ ਹਾਂਜੀ ਧੰਨਵਾਦ ਓਕੇ